ਹੈਲੋ ਤੁਸੀਂ ਚਾਰੂ ਦੇ ਪਾਪਾ ਹੋ ਓਕੇ ਮੈਂ ਮਾਨਸੇ ਦੀ ਮੰਮਾ ਇਹ ਛੋਟੀਆਂ ਬੱਚੀਆਂ ਰੋਜ਼ ਖੇਡਦੀਆਂ ਨੇ ਨਾ ਤਾਂ ਕਰਕੇ ਮੈਨੂੰ ਥੋੜ੍ਹੀ ਜੀ ਪਛਾਣ ਹੈ ਤੁਹਾਡੀ ਸਤਿ ਸ਼੍ਰੀ ਅਕਾਲ ਅਤੇ ਤੁਸੀਂ ਇਹ ਇਹਦੀ ਐਡਮਿਸ਼ਨ ਬਾਰੇ ਸੋਚਿਆ ਹੈ ਇਸ ਵਾਰ ਹੁਣ ਤੇ ਇਹਨਾਂ ਦੀ ਉਮਰ ਹੋ ਗਈ ਤਿੰਨ ਕੁ ਸਾਲ ਐਡਮਿਸ਼ਨ ਬਾਰੇ ਸੋਚਿਆ ਕੁਛ ਅੱਛਾ ਜੀ ਓਕੇ ਓਕੇ ਮੈਂ ਵੀ ਮਾਨਵ ਮੰਗਲ 'ਚ ਗਈ ਸੀਗੀ ਅਤੇ ਇੱਕ ਵੁੜਕ ਬੜੀ ਸਕੂਲ ਹੈ ਉੱਥੇ ਗਈ ਸੀਗੀ ਪਰ ਉਹਨਾਂ ਦਾ ਫ਼ੀਸਾਂ ਦਾ ਸ਼ਡਿਊਲ ਇੱਕ ਤਾਂ ਮੈਨੂੰ ਨਹੀਂ ਸਮਝ ਆਇਆ ਵੀ ਕਿਉਂ ਇੰਨੀਆਂ ਜ਼ਿਆਦਾ ਫ਼ੀਸਾਂ ਲੈ ਰਹੇ ਨੇ ਅਤੇ ਦੂਸਰਾ ਹਾਲੇ ਮੈਂ ਇਹ ਦੇਖਿਆ ਕਿ ਉੱਥੇ ਸਟਰੈਂਥ ਬਹੁਤ ਜ਼ਿਆਦਾ ਅਤੇ ਤਾਂ ਮੈਨੂੰ ਮਹਿਸੂਸ ਹੋਇਆ ਵੀ ਹੋ ਸਕਦਾ ਉੱਥੇ ਇੰਨੀ ਸਟੱਡੀ ਨਾ ਹੋਵੇ ਸ਼ਿਵਾਲਿਕ 'ਚ ਕਿਵੇਂ ਹੈ ਓਕੇ ਓਕੇ ਓਕੇ ਨਾਲੇ ਆਪਣੀ ਪਹੁੰਚ ਵਿੱਚ ਹੈ ਬੱਚੇ ਲੇਟ ਜਾਇਆ ਕਰਨਗੇ ਅਤੇ ਜਲਦੀ ਘਰ ਆ ਜਾਇਆ ਕਰਨਗੇ

ਹਾਂ ਇਹ ਮੈਨੂੰ ਫੈਸਿਲਿਟੀ ਬਹੁਤ ਵਧੀਆ ਲੱਗੀ ਕਿਉਂਕਿ ਘਰ ਦੇ ਨੇੜੇ ਜਿਹੜਾ ਵੀ ਆਪਣੇ ਐਜੂਕੇਸ਼ਨ ਪ੍ਰੋਵਾਈਡ ਕਰਨ ਦਾ ਸਾਧਨ ਹੈ ਆਪਾਂ ਨੂੰ ਉੱਥੇ ਹੀ ਕਰਵਾਉਣਾ ਚਾਹੀਦਾ ਬੱਚੇ ਨੂੰ ਤਾਂ ਕਿ ਐਵੇਂ ਸੜਕਾਂ 'ਤੇ ਬੱਚਾ ਘੁੰਮਦਾ ਨਾ ਰਹੇ ਬਹੁਤ ਵਧੀਆ ਗੱਲ ਹੈ ਵੀ ਅਪ ਤੁਸੀਂ ਸ਼ਿਵਾਲਿਕ ਚੁਣਿਆ ਮੈਂ ਵੀ ਕੱਲ੍ਹ ਨੂੰ ਜਾ ਕੇ ਬੇਟੀ ਦੀ ਉੱਥੇ ਹੀ ਐਡਮਿਸ਼ਨ ਕਰਵਾਉਣ ਦੀ ਸੋਚੂੰਗੀ ਮਾਨਸੀ ਨੇ ਕਿਉਂਕਿ ਚਾਰੂ ਨਾਲ ਇਹਦਾ ਬਹੁਤ ਜ਼ਿਆਦਾ ਪਿਆਰ ਹੈ ਅਤੇ ਇਸ ਕਰਕੇ ਇਕੱਠੀਆਂ ਵੀ ਰਹਿਣਗੀਆਂ ਸਕੂਲ 'ਚ ਸਹੀ ਗੱਲ ਹੈ ਨਾਲੇ ਬੱਚਿਆਂ ਦੀ ਆਊਟਪੁੱਟ ਦੋਵਾਂ ਦੀ ਇੱਕ ਜਣਾ ਜਾ ਕੇ ਹੀ ਪਤਾ ਕਰਕੇ ਆ ਸਕਦਾ ਓਕੇ ਧੰਨਵਾਦ ਮੈਨੂੰ ਜਾਣਕਾਰੀ ਦੇਣ ਦੇ ਲਈ ਫਿਰ ਮਿਲਦੇ ਹਾਂ ਓਕੇ